ਪੰਜਾਬ ਵਿੱਚ ਸਿਹਤ ਸੰਭਾਲ ਤੱਕ ਪਹੁੰਚ ਚੁਣੌਤੀਆਂ ਨਾਲ ਭਰੀ ਹੋਈ ਹੈ ਜੋ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਅਤੇ ਸਮਾਂ ਬੱਧਤਾ ਨੂੰ ਮਹੱਤਵਪੂਰਨ ਰੂਪ ਵਿੱਚ ਪ੍ਰਭਾਵਿਤ ਕਰਦੇ ਹਨ ਇੱਕ ਵੱਡਾ ਮੁੱਦਾ ਸਰਕਾਰੀ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ ਦੀ ਲਗਾਤਾਰ ਘਾਟ ਹੈ ਮਰੀਜ਼ਾਂ ਨੂੰ ਅਕਸਰ ਲੋੜੀਦੀਆਂ ਦਵਾਈਆਂ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਇਲਾਜ ਦੇ ਅਧੂਰੇ ਪ੍ਰਬੰਧ ਹੋ ਸਕਦੇ ਹਨ ਅਤੇ ਸਿਹਤ ਦੇ ਨਤੀਜੇ ਵਿਗੜ ਸਕਦੇ ਹਨ ਇਹ ਘਾਟ ਬਹੁਤ ਸਾਰੇ ਵਿਅਕਤੀਆਂ ਨੂੰ ਨਿੱਜੀ ਫਾਰਮੈਸੀਆਂ ਤੋਂ ਦਵਾਈਆਂ ਲੈਣ ਲਈ ਮਜਬੂਤ ਮਜ਼ਬੂਰ ਕਰਦੀ ਹੈ ਜਿਸ ਨਾਲ ਵਿੱਤੀ ਦਬਾਅ ਵੱਧਦਾ ਹੈ ਖਾਸ ਤੌਰ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਪਿਛੋਕੜ ਵਾਲੇ ਲੋਕਾਂ ਲਈ ਇਸ ਤੋਂ ਇਲਾਵਾ ਰਾਜਭਰ ਵਿੱਚ ਡਾਕਟਰੀ ਸਹੂਲਤਾਂ ਦੀ ਇੱਕ ਮਹੱਤਵਪੂਰਨ ਘਾਟ ਹੈ ਜਦੋਂ ਕਿ ਵੱਡੇ ਸ਼ਹਿਰਾਂ ਵਿੱਚ ਮੁਕਾਬਲਾ ਮੁਕਾਬਲਾ ਤਨ ਬਹਿਤਰ ਬੁਨਿਆਦੀ ਢਾਂਚਾ ਹੈ ਪੇਂਡੂ ਅਤੇ ਅਰਬ ਸ਼ਹਿਰੀ ਖੇਤਰ ਅਕਸਰ ਸੀਮਤ ਹਸਪਤਾਲਾਂ ਅਤੇ ਕਲੀਨਿਕਾਂ ਦੇ ਨਾਲ ਘੱਟ ਸੇਵਾ ਵਾਲੇ ਹੁੰਦੇ ਹਨ ਹੈਲਥ ਕੇਅਰ ਸਹੂਲਤ ਦੀ ਵੰਡ ਵਿੱਚ ਇਸ ਅਸਮਾਨਤਾ ਦਾ ਮਤਲਬ ਹੈ ਕਿ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਵਸਨੀਕਾਂ ਨੂੰ ਬੁਨਿਆਦੀ ਡਾਕਟਰੀ ਸੇਵਾਵਾਂ ਤੱਕ ਪਹੁੰਚਣ ਲਈ ਲੰਬੀ ਦੂਰੀ ਦੀ ਯਾਤਰਾ ਕਰਨੀ ਚਾਹੀਦੀ ਹੈ ਜੋ ਕਿ ਸਮਾਂ ਬਰਬਾਦ ਕਰਨ ਵਾਲੀਆਂ ਅਤੇ ਮਹਿੰਗੀਆਂ ਹੋ ਸਕਦੀਆਂ ਹਨ ਐਮਰਜੈਂਸੀ ਸੇਵਾਵਾਂ ਦੀ ਉਪਲੱਬਧਤਾ ਇੱਕ ਹੋਰ ਗੰਭੀਰ ਚਿੰਤਾ ਹੈ ਇਕ ਸੌ ਅੱਠ ਐਂਬੂਲੈਂਸ ਸੇਵਾ ਜੋ ਸਮੇਂ ਸਿਰ ਐਮਰਜੈਂਸੀ ਦੇਖਭਾਲ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ ਨੂੰ ਅਕਸਰ ਐਬੂਲੈਂਸ ਐਬੂਲੈਂਸਾਂ ਦੀ ਇਹਨਾਂ ਕਾਫ਼ੀ ਸੰਖਿਆ ਅਤੇ ਜਵਾਬ ਦੇ ਸਮੇਂ ਵਿੱਚ ਦੇਰੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸਦੇ ਗੰਭੀਰ ਨਤੀਜੇ ਹੋ ਸਕਦੇ ਹਨ ਖਾਸ ਤੌਰ 'ਤੇ ਐਮਰਜੈਂਸੀ ਵਿੱਚ ਜਿੱਥੇ ਹਰ ਮਿੰਟ ਦੀ ਗਿਣਤੀ ਹੁੰਦੀ ਹੈ ਇਸ ਤੋਂ ਇਲਾਵਾ ਕਈ ਪਿੰਡਾਂ ਦੀਆਂ ਸੜਕਾਂ ਦੀ ਮਾੜੀ ਹਾਲਤ ਇਹਨਾਂ ਦੇਰੀ ਨੂੰ ਹੋਰ ਵਧਾ ਦਿੰਦੀ ਹੈ ਨਾ ਕਾਫ਼ੀ ਬੁਨਿਆਦੀ ਢਾਂਚਾ ਐਂਬੂਲੈਂਸ ਲਈ ਮਰੀਜ਼ਾਂ ਤੱਕ ਜਲਦੀ ਪਹੁੰਚਣਾ ਮੁਸ਼ਕਿਲ ਬਣਾਉਣਾ ਹੈ ਗੰਭੀਰ ਸਹਿਤ ਨਤੀਜਿਆਂ ਜਾਂ ਗੰਭੀਰ ਪਲਾਂ ਦੌਰਾਨ ਮੌਤਾਂ ਦੇ ਜੋਖਮ ਨੂੰ ਵਧਾਉਂਦਾ ਹੈ ਦਿਹਾਤੀ ਖੇਤਰਾਂ ਨੂੰ ਵੀ ਵਿਆਪਕ ਬੁਨਿਆਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਵਿੱਚ ਨਾ ਕਾਫ਼ੀ ਸਿਹਤ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਿਹਤ ਸੰਭਾਲ ਪੇਸ਼ੇਵਰਾਂ ਦੀ ਘਾਟ ਸ਼ਾਮਲ ਹੈ ਇਸ ਦੇ ਨਤੀਜੇ ਵਜੋਂ ਵਿਸ਼ੇਸ਼ ਦੇਖਭਾਲ ਅਤੇ ਰੋਕਥਾਮ ਸੇਵਾਵਾਂ ਤੱਕ ਸੀਮਤ ਪਹੁੰਚ ਹੁੰਦੀ ਹੈ ਜਿਸ ਨਾਲ ਸ਼ਹਿਰੀ ਅਤੇ ਪੇਂਡੂ ਆਬਾਦੀ ਦੇ ਵਿਚਕਾਰ ਸਿਹਤ ਅਸਮਾਨਤਾਵਾਂ ਹੋਰ ਵੱਧਦੀਆਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਿਹਤ ਸੰਭਾਲ ਪੇਸ਼ੇਵਰਾ ਦੀ ਇੱਕ ਆਮ ਘਾਟ ਹੈ ਜੋ ਦੇਖਭਾਲ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਮਰੀਜ਼ਾਂ ਲਈ ਉਡੀਕ ਸਮਾਂ ਵਧਾਉਂਦੀ ਹੈ ਦੂਰ ਦੁਰਾਡੇ ਦੇ ਖੇਤਰਾਂ ਵਿੱਚ ਸਿੱਖਿਅਤ ਡਾਕਟਰਾਂ ਨਰਸਾਂ ਅਤੇ ਹੋਰ ਮੈਡੀਕਲ ਸਟਾਫ ਦੀ ਕਮੀ ਦਾ ਅਕਸਰ ਮਤਲਬ ਹੁੰਦਾ ਹੈ ਕਿ ਉਪਲੱਬਧ ਪੇਸ਼ੇਵਰ ਜ਼ਿਆਦਾ ਕੰਮ ਕਰਦੇ ਹਨ ਅਤੇ ਮਰੀਜ਼ਾਂ ਨੂੰ ਘੱਟ ਵਿਅਕਤੀਗਤ ਧਿਆਨ ਦਿੱਤਾ ਜਾਂਦਾ ਹੈ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਫੰਡਿੰਗ ਵਧਾਉਣਾ ਬੁਨਿਆਦੀ ਢਾਚੇ ਵਿੱਚ ਸੁਧਾਰ ਕਰਨਾ ਅਤੇ ਟੈਲੀਮੈਡੀਸਨ ਸੇਵਾਵਾਂ ਦਾ ਵਿਸਥਾਰ ਕਰਨਾ ਹਾਲਾਂਕਿ ਇਹਨਾਂ ਪਰਾ ਪ੍ਰਣਾਲੀਗਤ ਚੁਣੌਤੀਆਂ 'ਤੇ ਕਾਬੂ ਪਾਉਣ ਲਈ ਪੰਜਾਬ ਦੇ ਸਾਰੇ ਵਸਨੀਕਾਂ ਲਈ ਬਥੇਰੇ ਬਰਾਬਰ ਅਤੇ ਕੌਸ਼ਲ ਸਿਹਤ ਸੰਭਾਲ ਪਹੁੰਚ ਨਜ਼ਦੀਕੀ ਬਣਾਉਣ ਲਈ ਸਰਕਾਰ ਅਤੇ ਨਿੱਜੀ ਖੇਤਰ ਦੋਵਾਂ ਵੱਲੋਂ ਠੋਸ ਯਤਨਾਂ ਦੀ ਲੋੜ ਹੈ